ਤਿੰਨ ਜਨਵਰੀ ਦੋ ਹਜ਼ਾਰ ਸਤਾਰ੍ਹਾਂ ਨਵੰਬਰ ਦੋ ਹਜ਼ਾਰ ਸੱਤ ਸੱਤ ਅਗਸਤ ਉੱਨੀ ਸੌ ਸੰਤਾਲ਼ੀ ਪੰਦਰਾਂ ਅਕਤੂਬਰ ਦੋ ਹਜ਼ਾਰ ਤੇਈ ਅਠਾਰ੍ਹਾਂ ਅਪ੍ਰੈਲ ਉੱਨੀ ਸੌ ਛਪੰਜਾ